ਮੇਰੀ ਮਨਪਸੰਦ ਫ਼ਿਲਮ ਹੈ ਜਵਾਨ ਸ਼ਾਹਰੁਖ ਖਾਨ ਦੀ ਨਵੀਂ ਆਈ ਮੂਵੀ ਦੋ ਹਜ਼ਾਰ ਤੇਈ 'ਚ ਜਿਹੜੀ ਲਾਂਚ ਹੋਈ ਹੈ ਪਰਸੋਂ ਹੀ ਮੈਂ ਦੇਖੀ ਸੀ ਉਹ ਮੂਵੀ ਬਹੁਤ ਹੀ ਅੱਛੀ ਹੈ ਦੇਸ਼ ਦੀ ਰਾਜਨੀਤੀ ਬਾਰੇ ਕਈ ਗੱਲਾਂ ਉਹਦੇ ਵਿੱਚ ਦੱਸੀਆਂ ਗਈਆਂ ਨੇ ਸਾਨੂੰ ਸਾਡੇ ਵੋਟਾਂ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ ਕਿ ਅਸੀਂ ਵੋਟ ਪਾ ਤਾਂ ਦਿੰਦੇ ਹਾਂ ਲੇਕਿਨ ਉਸ ਵੋਟ ਨੂੰ ਕਿੱਥੇ ਪਾਉਣਾ ਹੈ ਉਹ ਆਪਣੇ ਦਿਮਾਗ਼ ਨਾਲ਼ ਪਾਉਣਾ ਚਾਹੀਦਾ ਕਿਸੇ ਦੇ ਦਬਾਅ ਵਿੱਚ ਆ ਕੇ ਜਾਂ ਕਿਸੇ ਲਾਲਚ ਵਿੱਚ ਆ ਕੇ ਕਦੇ ਨਹੀਂ ਪਾਉਣਾ ਚਾਹੀਦਾ ਕਿਉਂਕਿ ਉਸ ਦੇ ਨਤੀਜਿਆਂ ਨੂੰ ਸਾਨੂੰ ਪੰਜ ਸਾਲ ਭੁਗਤਣਾ ਪੈਂਦਾ ਹੈ ਜੋ ਵੀ ਸਰਕਾਰ ਆਉਂਦੀ ਹੈ ਤੁਹਾਨੂੰ ਕਈ ਤਰ੍ਹਾਂ ਦੇ ਵਾਅਦੇ ਕਰਦੀ ਹੈ ਕਈ ਤਰ੍ਹਾਂ ਦਾ ਲਾਲਚ ਕ ਦਿੰਦੀ ਹੈ ਇਹੀ ਦਰਸਾਇਆ ਗਿਆ ਉਸ ਮੂਵੀ ਵਿੱਚ ਬਹੁਤ ਅੱਛੀ ਮੂਵੀ ਸੀਗੀ ਮੈਂ ਤਾਂ ਕਹੂੰਗਾ ਸਾਰੇ ਲੋਕ ਦੇਖਣ ਤਾਂ ਜੋ ਉਹ ਜਾਗਰੂਕ ਹੋ ਸਕਣ ਇਸ ਮੂਵੀ ਤੋਂ ਸ਼ਾਹਰੁਖ ਖਾਨ ਨੇ ਬਹੁਤ ਵ ਵਧੀਆ ਦੱਸਿਆ ਹੈ ਕਿ ਸਾਡੇ ਇਹ ਦੇਸ਼ ਵਿੱਚ ਕਿਹਨਾਂ ਕਿਹਨਾਂ ਚੀਜ਼ਾਂ ਦੀਆਂ ਕਮੀਆਂ ਕਿਤਾਬਾਂ ਵਿੱਚ ਉਹ ਤਾਂ ਕਈ ਕੁਛ ਦਿਖਾ ਦਿੰਦੇ ਨੇ ਕਿ ਅਸੀਂ ਉੱਥੇ ਹੋਸਪੀਟਲ ਬਣਾਏ ਨੇ ਇਹ ਫੈਸਲਿਟੀਜ਼ ਪ੍ਰੋਵਾਈਡ ਕੀਤੀਆਂ ਨੇ ਲੇਕਿਨ ਉਹ ਸਿਰਫ਼ ਕਾਗਜ਼ਾਂ ਵਿੱਚ ਹੀ ਹੁੰਦਾ ਆ ਉਹਦੀ ਬਣਦੀਆਂ ਰਕਮਾਂ ਜਿਹੜਾ ਇੰਨਾਂ ਪੈਸਾ ਲੱਗਦਾ ਹੈ ਉਹ ਬੜੇ ਬੜੇ ਸਾਡੇ ਲੀਡਰ ਲੋਕ ਖਾ ਜਾਂਦੇ ਨੇ ਜਨਤਾ ਕੋਲ ਫਿਰ ਵੀ ਉਹੀ ਟੁੱਟੇ ਹਸਪਤਾਲ ਟੁੱਟੇ ਸਕੂਲ ਉਹੀ ਰਹਿ ਜਾਂਦੇ ਨੇ ਸੋ ਸਾਡੇ ਕੋਲ਼ ਗਰੀਬ ਤੋਂ ਗਰੀਬ ਬੰਦੇ ਕੋਲ਼ ਇੱਕੋ ਹੀ ਪਾਵਰ ਹੈ ਉਹ ਹੈ ਵੋਟ ਦੀ ਉਹ ਕਹਿੰਦਾ ਹੈ ਕਿ ਵੋਟ ਪਾਓ ਲੇਕਿਨ ਆਪਣੀ ਮਰਜ਼ੀ ਨਾਲ਼ ਨਾ ਪਾਓ ਮਰਜ਼ੀ ਨਾਲ਼ ਪਾਓ ਸੋਰੀ ਵੋਟ ਇੱਕ ਐਸੀ ਚੀਜ਼ ਹੈ ਜੋ ਪੰਜ ਸਾਲ ਲਈ ਸਾਨੂੰ ਇੱਦਾਂ ਦੇ ਬੰਦੇ ਨੂੰ ਅੱਗੇ ਲੈ ਕੇ ਆਉਂਦੀ ਹੈ ਜੋ ਸਾਡੇ ਭਵਿੱਖ ਨੂੰ ਬਣਾਉਂਦੀ ਹੈ ਇਹੀ ਚੀਜ਼ ਉਹਨਾਂ ਨੇ ਉਸ ਮੂਵੀ ਵਿੱਚ ਦੱਸਿਆ ਮੈਨੂੰ ਬਹੁਤ ਅੱਛੀ ਲੱਗੀ ਉਹ ਮੂਵੀ ਮੈਂ ਚਾਹੁੰਦਾ ਕਿ ਸਾਰਾ ਦੇਸ਼ ਦੇਖੇ ਉਸ ਮੂਵੀ ਨੂੰ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਉਤਾਰੇ ਬਹੁਤ ਹੀ ਵਧੀਆ ਮੂਵੀ ਹੈ ਜਵਾਨ